ਅਸੀਂ ਤੈਰਾਕੀ ਮੁਕਾਬਲੇ ਤੋਂ ਪਹਿਲਾਂ ਪ੍ਰੀ ਰੇਸ ਦੀਆਂ ਚਿੰਤਾ ਨੂੰ ਸੰਭਾਲਣ ਲਈ ਕਈ ਕਦਮ ਚੁੱਕਦੇ ਹਾਂ ਅਸੀਂ ਸਭ ਤੋਂ ਪਹਿਲਾਂ ਆਪਣੇ ਉੱਪਰ ਭਰੋਸਾ ਰੱਖਦੇ ਹਾਂ ਕਿ ਅਸੀਂ ਇਹ ਰੇਸ ਜਿੱਤ ਸਕਦੇ ਹਾਂ ਅਤੇ ਇਸ ਦੇ ਨਾਲ ਹੀ ਅਸੀਂ ਕੋਈ ਵੀ ਤਰ੍ਹਾਂ ਦੀ ਮੁਕਾਬਲੇ ਦੀ ਟੈਂਸ਼ਨ ਨਹੀਂ ਲੈਂਦੇ ਅਸੀਂ ਅਜੇ ਤੱਕ ਪੇਸ਼ਾਵਰ ਤੈਰਾਕੀ ਮੁਕਾਬਲੇ ਵਿੱਚ ਹਿੱਸਾ ਨਹੀਂ ਲਿਆ ਪਰ ਮੈਂ ਇਸ ਮੁਕਾਬਲੇ ਵਿੱਚ ਹਿੱਸਾ ਲੈਣਾ ਚਾਹੁੰਦਾ ਹਾਂ ਕਿਉਂਕਿ ਮੇਰਾ ਸੁਪਨਾ ਹੈ ਕਿ ਮੈਂ ਇੱਕ ਅੰਤਰਾਸ਼ਟਰੀਆ ਤੈਰਾਕੀ ਵਿੱਚ ਹਿੱਸਾ ਲੈ ਕੇ ਅਤੇ ਉਸ ਨੂੰ ਜਿੱਤ ਸਕਾਂ ਤਾਂ ਕਿ ਮੈਂ ਬਚਪਨ ਦਾ ਇਹ ਸੁਪਨਾ ਪੂਰਾ ਹੋ ਸਕੇ ਮੇਰੇ ਵਿੱਚ ਤੈਰਾਕੀ ਕਰਨ ਦੇ ਕਈ ਗੁਣ ਹਨ ਮੈਂ ਇੱਕ ਅ ਅੱਛਾ ਤੈਰਾਕੀਕਾਰ ਹਾਂ ਹਜੇ ਤੱਕ ਮੈਂ ਆਪਣੇ ਡਿਸਟਰਿਕਟ ਲੈਵਲ ਵਿਚ ਤੈਰਾਕੀ ਦੇ ਕਈ ਮੁਕਾਬਲੇ ਵੀ ਜਿੱਤੇ ਹਨ ਅਤੇ ਦੋ ਵਾਰ ਮੈਂ ਨੈਸ਼ਨਲ ਤੈਰਾਕੀ ਪ੍ਰਯੋਗ ਪ੍ਰਤੀਯੋਗਤਾ ਲਈ ਵੀ ਗਿਆ ਸੀ ਅਤੇ ਜਿੱਤ ਵੀ ਹਾਸਿਲ ਕੀਤੀ ਸੀ